ਹਾਂਜੀ ਮੈਂ ਕਾਫ਼ੀ ਦਿਨ ਦੀ ਯਾਤਰਾ ਕੀਤੀ ਹੋਈ ਹੈ ਜਿਹੜੇ ਮੇਰੇ ਤਜ਼ਰਬਾ ਸੀਗਾ ਬਹੁਤ ਵਧੀਆ ਰਿਹਾ ਇਸ ਯਾਤਰਾ ਵਿੱਚ ਮੈਂ ਹਿਮਾਚਲ ਪ੍ਰਦੇਸ਼ ਗਿਆ ਸੀ ਜਿੱਥੇ ਅਸੀਂ ਤੰਬੂਆਂ ਦੇ ਵਿੱਚ ਰਾਤ ਗੁਜ਼ਾਰੀ ਸੀਗੀ ਤੰਬੂਆਂ ਵਿੱਚ ਰਹਿਣਾ ਦਾ ਜਿਹੜਾ ਤਜ਼ਰਬਾ ਹੈਗਾ ਅਤੇ ਬਹੁਤ ਵਧੀਆ ਲੱਗਿਆ ਅਤੇ ਜਿਹੜਾ ਸਾਡਾ ਇਹ ਯਾਤਰਾ ਸੀਗੀ ਇਹ ਕਾਫ਼ੀ ਯਾਦਗਰ ਰਹੀ ਹੈ